ਹੈਲੋ ਹਾਂਜੀ ਤੁਸੀਂ ਬਿਜਲੀ ਬੋਰਡ ਦਫਤਰ ਬਰਨਾਲਾ ਵਿਖੇ ਬੋਲ ਰਹੇ ਹਨ ਮੈਂ ਬਲਜੀਤ ਸਿੰਘ ਬੋਲ ਰਿਹਾ ਹਾਂ ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਤੋਂ ਮੈਂ ਛੋਟੀ ਜਿਹੀ ਇੱਕ ਵਰਕਸਾਪ ਲਗਾਈ ਸੀ ਜਿਸ ਦਾ ਲੋਡ ਦਸ ਕਿਲੋਵਾਟ ਕਰਵਾਇਆ ਸੀ ਹੁਣ ਮੇਰੀ ਮਸ਼ੀਨਰੀ ਫਿੱਟ ਹੋ ਚੁੱਕੀ ਹੈ ਮੈਂ ਮਸ਼ੀਨਾਂ ਚਲਾ ਕੇ ਚੈੱਕ ਕਰਨਾ ਚਾਹੁੰਦਾ ਹਾਂ ਕਿ ਮੇਰੀਆਂ ਕਿੰਨੀਆਂ ਯੂਨੀਟਸ ਦੀ ਖਪਤ ਇੱਕ ਦਿਨ ਵਿੱਚ ਹੋ ਜਾਂਦੀ ਹੈ ਤਾਂ ਜੋ ਮੈਂ ਇੱਕ ਮਹੀਨੇ ਦਾ ਹਿਸਾਬ ਲਗਾ ਸਕਾਂ ਅਤੇ ਆਪਣੇ ਆਮਦਨ ਖਰਚੇ ਦਾ ਅੰਦਾਜ਼ਾ ਲਗਾ ਸਕਾਂ ਕਿ ਬਿਜਲੀ ਦੀ ਖਪਤ ਕਿੰਨੀ ਕੁ ਹੋ ਜਾਂਦੀ ਹੈ ਅਤੇ ਕਿੰਨੀ ਕੁ ਘੱਟ ਕਰਨੀ ਪਵੇਗੀ ਜਿਸ ਨਾਲ ਮੇਰੀ ਆਮਦਨ ਵਧੇ ਅਤੇ ਖਰਚ ਕੰਟਰੋਲ ਵਿੱਚ ਰਹੇ ਕਿਰਪਾ ਕਰਕੇ ਮੇਰੇ ਬਿਜਲੀ ਮੀਟਰ ਦੀ ਰੀਡਿੰਗ ਕੀਤੀ ਜਾਵੇ ਅਤੇ ਹੋ ਸਕੇ ਤਾਂ ਇੱਕ ਸਬ ਮੀਟਰ ਵੀ ਲਗਾਇਆ ਦਿੱਤਾ ਜਾਵੇ ਤਾਂ ਜੋ ਮੈਨੂੰ ਸਮੇਂ ਸਮੇਂ 'ਤੇ ਪਤਾ ਲੱਗਦਾ ਰਹੇ ਕਿ ਸਾਡੀਆਂ ਮਸ਼ੀਨਰੀ ਦੁਆਰਾ ਇੱਕ ਦਿਨ ਵਿੱਚ ਕਿੰਨੀਆਂ ਯੂਨਿਟਾਂ ਦੀ ਖਪਤ ਹੋ ਰਹੀ ਹੈ ਅਤੇ ਅਸੀਂ ਇਸ ਨੂੰ ਘੱਟ ਤੋਂ ਘੱਟ ਕਿਸ ਤਰ੍ਹਾਂ ਕੰਟਰੋਲ ਵਿੱਚ ਕਰੀਏ ਕਿ ਸਾਡੀ ਬਿਜਲੀ ਦੀ ਖਪਤ ਘੱਟ ਰਹੇ ਅਤੇ ਸਾਡੀ ਯੂਨਿਟਸ ਦੀ ਘੱਟ ਆਵੇ ਤਾਂ ਜੋ ਸਾਡੇ ਖਰਚੇ ਘਟਣ ਅਤੇ ਬਿਜਲੀ ਦਾ ਬਿਲ ਵੀ ਘੱਟ ਆਵੇ ਇੱਕ ਮਹੀਨੇ ਦਾ ਖਰਚ ਦਾ ਅੰਦਾਜ਼ਾ ਵੀ ਲਗਾ ਸਕੀਏ ਤਾਂ ਜੋ ਅਸੀਂ ਆਮਦਨ ਅਤੇ ਖਰਚ ਦਾ ਆਪਸ ਵਿੱਚ ਹਿਸਾਬ ਲਗਾ ਸਕੀਏ ਅਤੇ ਤਾਂ ਇਸ ਤੋਂ ਪਤਾ ਲੱਗ ਜਾਵੇਗਾ ਸਾਡੀ ਮਸ਼ੀਨਰੀ ਕਿੰਨੀ ਕੁ ਬਿਜਲੀ ਦੀ ਖਪਤ ਕਰ ਰਹੀ ਹੈ